ਹਾਂ ਇਹ ਸੱਚ ਹੈ ਕਿ ਮੀਡੀਆ ਅਤੇ ਸਿੱਖਿਆ ਪ੍ਰਣਾਲੀ ਵਿੱਚ ਪੰਜਾਬੀ ਭਾਸ਼ਾ ਨੂੰ ਉਚਿਤ ਰੂਪ ਵਿੱਚ ਦਰਸਾਇਆ ਜਾਂਦਾ ਹੈ ਜਿਵੇਂ ਕਿ ਪੰਜਾਬ ਦੇ ਟੈਲੀਵਿਜ਼ਨਾਂ 'ਤੇ ਕੁਛ ਚੈਨਲ ਚੱਲਦੇ ਹਨ ਜਿਵੇਂ ਕਿ ਏ ਬੀ ਪੀ ਨਿਊਜ਼ ਅਤੇ ਆਜ ਤੱਕ ਇਹਨਾਂ ਦੇ ਵਿੱਚ ਪੰਜਾਬੀ ਭਾਸ਼ਾ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਅਤੇ ਜੋ ਸਾਡੇ ਖਬਰਾਂ ਵਾਲੇ ਚੈਨਲ ਹਨ ਉਹਨਾਂ ਦੇ ਵਿੱਚ ਵੀ ਆਮ ਤੌਰ 'ਤੇ ਪੰਜਾਬੀ ਵਿੱਚ ਹੀ ਖਬਰਾਂ ਦੱਸੀਆਂ ਜਾਂਦੀਆਂ ਹਨ ਤਾਂ ਜੋ ਲੋਕ ਪੰਜਾਬੀ ਦੇ ਵਿੱਚ ਪੜ੍ਹ ਨਹੀਂ ਸਕਦੇ ਉਹ ਉਸ ਨੂੰ ਸੁਣ ਕੇ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਪੰਜਾਬ ਦੇ ਵਿੱਚ ਕੀ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਸਿੱਖਿਆ ਪ੍ਰਣਾਲੀ ਵੀ ਬਹੁਤ ਉਚਿਤ ਕੰਮ ਕਰ ਰਹੀ ਹੈ ਉਸ ਸ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਪੰਜਾਬੀ ਸਬਜੈਕਟ ਨੂੰ ਲਾਜ਼ਮੀ ਕੀਤਾ ਗਿਆ ਹੈ ਤਾਂ ਜੋ ਸਾਰੇ ਬੱਚੇ ਪੰਜਾਬੀ ਭਾਸ਼ਾ ਨੂੰ ਪੜ੍ਹ ਸਕਣ ਅਤੇ ਪੰਜਾਬੀ ਸਾਡੀ ਮਾਂ ਬੋਲੀ ਹੈ ਐ ਜਿਸ ਕਰਕੇ ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀ ਆਪਣੇ ਪਰਿਵਾਰਾਂ ਦੇ ਵਿੱਚ ਸਿਰਫ ਪੰਜਾਬੀ ਵਿੱਚ ਹੀ ਗੱਲ ਕਰਦੇ ਹਨ